ਹੈਲੋ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਮੈਂ ਨਾ ਜੀ ਆਪਣੇ ਰਮੇਸ਼ ਕੁਮਾਰ ਗੱਲ ਕਰ ਰਿਹਾ ਸੀਗਾ ਹਾਂ ਮੈਂ ਤੁਹਾਡੇ ਸ਼ਹਿਰ ਆਇਆ ਸੀ ਜੀ ਘੁੰਮਣ ਵਾਸਤੇ ਅਤੇ ਮੈਨੂੰ ਤੁਸੀਂ ਇਹ ਦੱਸੋ ਵੀ ਤੁਹਾਡੇ ਸ਼ਹਿਰ ਦੇ ਵਿੱਚ ਕਿਹੜੀਆਂ ਖਾਣ ਪੀਣ ਦੀਆਂ ਦੁਕਾਨਾਂ ਹੈਗੀਆਂ ਹੈ ਜਿਹੜੀਆਂ ਕੋਈ ਆਪਣੇ ਕੋਈ ਹੋਰ ਡਿਸ਼ ਹੈਗੀਆਂ ਮੈਂ ਯੂਟਿਊਬ 'ਤੇ ਵਲੋਗਰ ਹੈਗਾ ਅਤੇ ਤੁਹਾਡੇ ਸ਼ਹਿਰ ਵਿਚ ਜਿਹੜੀਆਂ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਜਾਂ ਆਪਣੇ ਹੋਰ ਕੋਈ ਰਿਫਰੈਸ਼ਮੈਂਟ ਹੈਗੀ ਹੈ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ ਅਤੇ ਦੱਸੋ ਮੈਨੂੰ ਦੋ ਤਿੰਨ ਘਰ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਜੋ ਤੁਹਾਡੇ ਗੁਲਸ਼ਨ ਸਵੀਟ ਹਾਊਸ ਵਾਲੇ ਹੈਗੇ ਹੈ ਸ਼ੋਪ ਹੈਗੀ ਹੈ ਸਵੀਟ ਦੀ ਉਹਨਾਂ ਦੇ ਕੀ ਖ਼ਾਸ ਮਸ਼ਹੂਰ ਆਈਟਮ ਕੀ ਹੈ ਜੀ ਜਿਹਦੇ ਕਰਕੇ ਸ਼ਹਿਰ ਦੇ ਵਿੱਚ ਉਹਨਾਂ ਦਾ ਨਾਮ ਚਲਦਾ ਜਾਂ ਮਸ਼ਹੂਰ ਹੋਏ ਵੇ ਹੈ ਗਰਮ ਗੁਲਾਬ ਜਾਮੁਨ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਉਹਨਾਂ ਦਾ ਕੀ ਮਸ਼ਹੂਰ ਹੈ ਜੀ ਆਰਤੀ ਸਵੀਟ ਹਾਊਸ ਜਿਹੜੀ ਤੁਹਾਡੇ ਹੈਗੀ ਆ

ਅੱਛਾ ਰਸਮਲਾਈ ਮਸ਼ਹੂਰ ਹੈ ਉਹਨਾਂ ਦੀ ਅਤੇ ਪ੍ਰਾਈਜ ਵਗੈਰਾ ਜੀ ਦੋਨਾਂ ਦੇ ਠੀਕ ਹੈ ਕਿਸ ਤਰ੍ਹਾਂ ਜੀ ਅਫੋਰਡੇਬਲ ਹੈਗੇ ਠੀਕ ਹੈ ਜੀ ਹੋਰ ਸਵੀਟ ਡਿਸ਼ ਦੇ ਵਿੱਚ ਜੀ ਮੰਨ ਕੇ ਚੱਲੋ ਆਪਣੇ ਜੇ ਆਈਸ ਕ੍ਰੀਮ ਵਗੈਰਾ ਦੀ ਹੈਗੀ ਆ ਅਸੀਂ ਗੱਲ ਕਰੀਏ ਤਾਂ ਮੁਕਲ ਆਈਸ ਕ੍ਰੀਮ ਵਾਲੇ ਠੀਕ ਹੈ ਜੀ ਅੱਛਾ ਕੀ ਕੁਆਲਿਟੀ ਦਿੰਦੇ ਜੀ ਉਹ ਆਈਸ ਕ੍ਰੀਮ ਦੇ ਵਿੱਚ ਜਾਂ ਕੁਲਫੀ ਦੇ ਵਿੱਚ ਅੱਛਾ ਜੋ ਦੁੱਧ ਵਗੈਰਾ ਵਰਤਦੇ ਇਹਨਾਂ ਦਾ ਇੱਕ ਨੰਬਰ ਦਾ ਦੁੱਧ ਹੁੰਦਾ ਜਾਂ ਕਿਸ ਤਰ੍ਹਾਂ ਵੀ ਜਿਵੇਂ ਅੱਜ ਕੱਲ੍ਹ ਮਿਕਸਿੰਗ ਚੱਲ ਰਹੀ ਹੈ ਇੱਕ ਨੰਬਰ ਹੋਏ ਠੀਕ ਹੈ ਜੀ ਠੀਕ ਹੈ ਜੀ